ਚਾਰ ਜਨਵਰੀ ਦੋ ਹਜ਼ਾਰ ਚਾਰ ਪੱਚੀ ਦਸੰਬਰ ਦੋ ਹਜ਼ਾਰ ਬਾਈ ਪੰਦਰਾਂ ਜੂਨ ਦੋ ਹਜ਼ਾਰ ਬਾਰਾਂ ਤੀਹ ਅਗਸਤ ਦੋ ਹਜ਼ਾਰ ਇੱਕ ਪੰਜ ਮਈ ਦੋ ਹਜ਼ਾਰ ਬਾਈ